ਬਾਈਕਿੰਗ ਦੁਆਰਾ ਸਮਾਜਿਕ ਨਾਲ ਸਾਨੂੰ ਜ ਪ੍ਰਦੂਸ਼ਣ ਤੋਂ ਵਧੀਆ ਸਹੀ ਰਹਿੰਦੇ ਹਾਂ ਤਾਂ ਸਾਨੂੰ ਪ੍ਰਦੂਸ਼ਣ ਜਿਵੇਂ ਕਾਰਾਂ ਚਲਾਉਣੀਆਂ ਉਹਨਾਂ ਦਾ ਧੂਆਂ ਰੋਲ ਹੋ ਜਾਂਦਾ ਅਤੇ ਸਾਡੇ ਸਰੀਰ ਨੂੰ ਨੁਕਸਾਨ ਬਹੁਤ ਪਹੁੰਚਾਉਂਦਾ ਹੈ ਇਸ ਲਈ ਸਾਨੂੰ ਸਾਈਂਕਲ ਦੀ ਵਰਤੋਂ ਕਰਨ ਨਾਲ ਲੱਤਾਂ ਗੋਡਿਆਂ ਬਾਹਾਂ ਸਰੀਰ ਨੂੰ ਬਹੁਤ ਹੀ ਆਰਾਮ ਕਰਦਾ ਹੈ ਬਾਈਕਰ ਚੰਗੀ ਭਾਵਨਾ ਹੈ ਇਸ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਇਹ ਆਪਣੇ ਸਾਈਕਲ ਚਲਾਉਣ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਅਤੇ ਨਾ ਕੋਈ ਬਿਮਾਰੀ ਦਾ ਡਰ ਲੱਗਦਾ ਹੈ ਇਸ ਲਈ ਸਾਨੂੰ ਪ੍ਰਦੂਸ਼ਣ ਤੋਂ ਬਚਣ ਲਈ ਸਾਈਂਕਲ ਦੀ ਵਰਤੋਂ ਵੱਧ ਤੋਂ ਵੱਧ ਜ਼ਰੂਰ ਕਰਨੀ ਚਾਹੀਦੀ ਹੈ ਟੈਕਸੀਆਂ ਚਲਾਉਣ ਦੇ ਨਾਲ ਧੂਆਂ ਰੋਲ ਹੋਣ ਕਰਕੇ ਆਪਣੇ ਸਰੀਰ ਦਾ ਨੁਕਸਾਨ ਬਹੁਤ ਹੁੰਦਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਹੀ ਸੰਕੇਤ ਦਿੰਦਾ ਹੈ ਕਿ ਸਾਨੂੰ ਸਾਈਂਕਲ ਹੀ ਸਭ ਤੋਂ ਵਧੀਆ ਲੱਗਦਾ ਹੈ ਅਤੇ ਨਾ ਹੀ ਇਸ ਦਾ ਕੋਈ ਕੋਈ ਖਰਚਾ ਹੁੰਦਾ ਹੈ ਇਸ ਲਈ ਸਾਨੂੰ ਸਾਈਂਕਲ ਵੱਧ ਤੋਂ ਵੱਧ ਚਲਾ ਕੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਅਤੇ ਨਾ ਕੋਈ ਬਿਮਾਰੀ ਨੇੜੇ ਆਉਂਦੀ ਹੈ ਅਸੀਂ ਇਹ ਹੀ ਸੰਕੇਤ ਕਰਦੇ ਹਾਂ ਅਗਰ ਸਾਈਂਕਲ ਸਾਡੇ ਜੀਵਨ ਲਈ ਬਹੁਤ ਹੀ ਚੰਗਾ ਹੈ ਇਸ ਲਈ ਸਾਈਂਕਲ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ